ਹਾਂਜੀ ਸਾਡੇ ਖੇਤਰ ਦੇ ਵਿੱਚ ਬਹੁਤ ਸਾਰੇ ਹਸਪਤਾਲ ਹੈ ਜਿੱਥੇ ਅਕਸਰ ਬਿਸਤਰੇ ਔਕਸੀਜਨ ਸਿਲੰਡਰ ਸਰਜੀਕਲ ਔਜ਼ਾਰਾਂ ਦੇ ਰੂਪ ਵਿੱਚ ਲੋੜੀਂਦੇ ਸਰੋਤ ਹਨ ਬਹੁਤ ਸਾਰੇ ਇਹੋ ਜਿਹੇ ਹਸਪਤਾਲ ਹੈ ਜਿਵੇਂ ਸਾਡੇ ਇੱਕ ਹਸਪਤਾਲ ਸਰਕਾਰੀ ਹੈ ਉਹਦੇ ਵਿੱਚ ਡਾਇਲਸਿਸ ਦਾ ਸਮਾਨ ਬਹੁਤ ਸਾਰਾ ਪਿਆ ਪਰ ਉਹਨੂੰ ਵਰਤੋਂ ਵਿੱਚ ਉਹਦਾ ਉਹਨੂੰ ਚਲਾਉਣ ਵਾਸਤੇ ਉਹਦੇ ਲੋੜੀਂਦੇ ਓਪਰੇਟਰ ਨਹੀਂ ਹੈ ਉਹ ਲੋੜੀਂਦੇ ਓਪਰੇਟਰਾਂ ਕਰਕੇ ਉੱਥੇ ਮਰੀਜ਼ ਤਾਂ ਆਉਂਦੇ ਬਹੁਤ ਸਾਰੇ ਪਰ ਇਸ ਕਰਕੇ ਮੁੜ ਜਾਂਦੇ ਹੈ ਜਾਂ ਉਹ ਜਵਾਬ ਦੇ ਦਿੰਦੇ ਵੀ ਸਾਡੇ ਕੋਲ ਇਹਦਾ ਓਪਰੇਟਰ ਹੈ ਨਹੀਂ ਮਸ਼ੀਨਰੀ ਹੈਗੀ ਹੈ ਕਰੋੜਾਂ ਰੁਪਏ ਦੀ ਪਰ ਉਹਨੂੰ ਵਰਤਣ ਵਾਸਤੇ ਉਹਦੇ ਓਪਰੇਟਰ ਜਿਹੜੀ ਹੈ ਉਹ ਸਰਕਾਰ ਉਪਲਬਧ ਨਹੀਂ ਕਰਵਾ ਸਕ ਸਕੀ ਇਸ ਕਰਕੇ ਮੈਂ ਵੀ ਇੱਕ ਵਾਰੀ ਇਕ ਪੇਸ਼ੈਂਟ ਨੂੰ ਲੈ ਕੇ ਗਿਆ ਸੀ ਜਗੀਰ ਸਿੰਘ ਸੀ ਪੇਸ਼ੈਂਟ ਉਹਦਾ ਡਾਇਲਸਿਸ ਕਰਵਾਉਣਾ ਸੀ ਡਾਇਲਸਿਸ ਕਰਵਾਉਣ ਵਾਸਤੇ ਅਸੀਂ ਲਗਭਗ ਦੋ ਘੰਟੇ ਉੱਥੇ ਖੱਜਲ ਖੁਆਰ ਹੁੰਦੇ ਰਹੇ ਪਰ ਆਖਰ ਦੇ ਵਿੱਚ ਇਹ ਸਿੱਟੇ 'ਤੇ ਪਹੁੰਚੇ ਵੀ ਸਾਡੇ ਕੋਲ ਮਸ਼ੀਨ ਤਾਂ ਹੈਗੀ ਹੈ ਪਰ ਇਹਦਾ ਓਪਰੇਟਰ ਨਹੀਂ ਹੈ ਓਪਰੇਟਰ ਦੂਸਰੇ ਸ਼ਹਿਰ ਤੋਂ ਲਿਆਉਣਾ ਪਵੇਗਾ ਫਿਰ ਦੂਸਰੇ ਦਿਨ ਗਏ ਦੂਸਰੇ ਦਿਨ ਅਸੀਂ ਆਪਣਾ ਇੱਕ ਪ੍ਰਾਈਵੇਟ ਓਪਰੇਟਰ ਲਿਆਂਦਾ ਦੂਸਰੇ ਹਸਪਤਾਲ ਤੋਂ ਪ੍ਰਾਈਵੇਟ ਤੋਂ ਬੁਲਾ ਕੇ ਅਤੇ ਫਿਰ ਉਹ ਮਸ਼ੀਨ ਨੂੰ ਚਲਾਇਆ ਅਤੇ ਤਾਂ ਉੱਥੇ ਡਾਇਲਸਿਸ ਹੋਈ ਉਹਦੇ ਬਾਰੇ ਕਈ ਵਾਰੀ ਆਵਾਜ਼ ਵੀ ਬੁਲੰਦ ਕੀਤੀ ਆਵਾਜ਼ ਬੁਲੰਦ ਕਰਨ ਦੇ ਨਾਲ਼ ਦੋ ਕੁ ਮਹੀਨੇ ਉੱਥੇ ਡੋਕਟਰ ਰਿਹਾ ਉਹਦਾ ਓਪਰੇਟਰ ਰਿਹਾ ਉਸ ਤੋਂ ਬਾਅਦ ਫਿਰ ਉਹਦੀ ਬਦਲੀ ਹੋਰ ਕਿਤੇ ਦੀ ਹੋ ਗਈ ਮਸ਼ੀਨ ਫਿਰ ਉਸੇ ਤਰ੍ਹਾਂ ਪਈ ਰਹਿ ਗਈ ਸੋ ਇਸ ਤਰ੍ਹਾਂ ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਕਈ ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਜੇ ਸਮਾਨ ਤਾਂ ਹੈ ਪਰ ਉਹਨੂੰ ਵਰਤਣ ਵਾਲੇ ਉੱਥੇ ਜਿਹੜੇ ਸਟਾਫ਼ ਲੋੜੀਂਦਾ ਸਟਾਫ਼ ਨਹੀਂ ਹੈ ਹੁਣ ਜੇ ਅਸੀਂ ਗੱਲ ਕਰੀਏ ਜ਼ਿਲ੍ਹੇ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ ਉਹਦੇ ਵਿੱਚ ਬੜੀ ਵੱਡੀ ਲੈਬ ਹੈ ਉਹ ਲੈਬ ਦੇ ਵਿੱਚ ਮੂਲ ਰੂਪ ਦੇ ਵਿੱਚ ਜਿਹੜੇ ਉਹਦੇ ਓਪਰੇਟਰ ਹੈ ਉਹਨੂੰ ਚਲਾਉਣ ਵਾਸਤੇ ਲੈਬ ਅਟੈਂਡਡੈਂਟ ਹੈ ਉਹ ਬੜੀ ਘੱਟ ਮਾਤਰਾ ਦੇ ਵਿੱਚ ਹੈ ਉਹ ਨਹੀਂ ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਹਸਪਤਾਲ ਦੇ ਵਿੱਚ ਕਿ ਉਹ ਜਿਹੜੇ ਟੈਸਟ ਹੋ ਰਹੇ ਹੈ ਉਹ ਟੈਸਟਾਂ ਨੂੰ ਲਗਭਗ ਇੱਕ ਵਜੇ ਤੱਕ ਤਾਂ ਚਲਾਉਣਾ ਚਾਹੀਦਾ ਪਰ ਉਹ ਸਵੇਰ ਨੂੰ ਹਸਪਤਾਲ ਖੁਲ੍ਹਦਿਆਂ ਦੋ ਘੰਟੇ ਦਾ ਸਮਾਂ ਉਹਨਾਂ ਦਾ ਅੱਠ ਤੋਂ ਦਸ ਵਜੇ ਤੱਕ ਉਹ ਸੈਂਪਲ ਲੈਂਦੇ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਅਸੀਂ ਇਹਨਾਂ ਨੂੰ ਅਸੀਂ ਸੈਂਪਲਾਂ ਨੂੰ ਉਹਨਾਂ ਦੇ ਰਿਸਰਚ ਵੀ ਕਰਨੀ ਹੈ ਉਹਨਾਂ ਦੇ ਟੈਸਟਾਂ ਵੀ ਕਰਨੀ ਰਿਪੋਰਟਾਂ ਵੀ ਦੇਣੀਆਂ ਇਸ ਕਰਕੇ ਦੋ ਘੰਟੇ ਕੰਮ ਕਰਦੇ ਜਦ ਕਿ ਉਹ ਜਿੰਨਾ ਸਮਾਂ ਹਸਪਤਾਲ ਚੱਲਦਾ ਉੱਨੇ ਸਮੇਂ 'ਚ ਉਹ ਜਿਹੜੀ ਹੈ ਲੈਬ ਚੱਲਦੀ ਹੋਣੀ ਚਾਹੀਦੀ ਹੈ ਉਹਨਾਂ ਦੀ ਵਜ੍ਹਾ ਇਹੀ ਹੈ ਕਿ ਉਹਦੇ ਵਿੱਚ ਲੋੜੀਂਦਾ ਸਟਾਫ਼ ਨਹੀਂ ਹੈਗਾ